ਜਿਵੇਂ ਗੱਲ ਕਰਾਂ ਆਪਣੇ ਮੋਬਾਈਲ ਫੋਨ ਦੀ ਤਾਂ ਸਭ ਤੋਂ ਪਹਿਲਾਂ ਫੋਨ ਮੇਰਾ ਸੀਗਾ ਨੋਕੀਆ ਦਾ ਤੇਤੀ ਪੰਦਰ੍ਹਾਂ ਆਉਂਦਾ ਹੁੰਦਾ ਸੀ ਬੜਾ ਸ਼ਾਨਦਾਰ ਸੈਟ ਸੀ ਹੈਵੀ ਜਿਹਾ ਸੀ ਸੈਟ ਪਰ ਜੇ ਸਮਾਰਟ ਫੋਨ ਦੀ ਕਿਉਂਕਿ ਇੱਥੇ ਗੱਲ ਹੋ ਰਹੀ ਹੈ ਅਤੇ ਮੇਰਾ ਪਹਿਲਾ ਸਮਾਰਟ ਫੋਨ ਸੀ ਸੈਮਸੰਗ ਦਾ ਗਲੈਕਸੀ ਐਸ ਟੂ ਵਾਈਟ ਕਲਰ ਦਾ ਫੋਨ ਸੀ ਸਲਿਕ ਪਤਲਾ ਜਿਹਾ ਫੋਨ ਸੀ ਬੜਾ ਸ਼ਾਨਦਾਰ ਚਲਾ ਕੇ ਅਲੱਗ ਹੀ ਮਜ਼ਾ ਆਉਂਦਾ ਸੀ ਪ੍ਰੋਸੈਸਰ ਬੜਾ ਤੇਜ਼ ਸੀ ਰੈਮ ਸ਼ੁਰੂ ਹੋਏ ਸੀਗੇ ਸਮਾਰਟ ਫੋਨ ਆਉਣੇ ਅਤੇ ਉਦੋਂ ਜਦੋਂ ਮੈਂ ਲਿਆ ਸੀ ਮੈਨੂੰ ਯਾਦ ਹੈ ਕਿ ਉਦੋਂ ਹਜੇ ਡਾਟਾ ਪੈਕ ਨਹੀਂ ਚਲਦੇ ਹੁੰਦੇ ਸੀਗੇ ਨੋਰਮਲੀ ਯੂਜ ਹੀ ਕਰਨਾ ਵੱਧ ਤੋਂ ਵੱਧ ਗੇਮ ਇੰਸਟਾਲ ਕਰ ਲੈਣੀ ਕੈਂਡੀ ਕ੍ਰਸ਼ ਬੜੀ ਚੱਲੀ ਸੀ ਉਸ ਟਾਈਮ 'ਤੇ ਕੈਂਡੀ ਕ੍ਰੱਸ਼ ਖੇਲਦੇ ਹੁੰਦੇ ਸੀ ਕੈਮਰਾ ਬਹੁਤ ਅੱਛਾ ਸੀ ਫੀਚਰ ਸਕਰੀਨ ਕਲੈਰਟੀ ਬੜੀ ਸ਼ਾਨਦਾਰ ਸੀ ਹੌਲੀ ਹੌਲੀ ਹੌਲੀ ਫਿਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਹੋਰ ਮੋਬਾਈਲ ਆਉਂਦੇ ਗਏ ਆਉਂਦੇ ਗਏ ਅਤੇ ਅੱਜ ਜੇ ਕੰਪੈਰੀਜਨ ਕਰਾਂ ਮੈਂ ਉਹਨਾਂ ਮੋਬਾਈਲਾਂ ਨਾਲ ਜੋ ਆਪਣੇ ਪਹਿਲੇ ਸਮਾਰਟ ਫੋਨ ਸੀ ਸਭ ਤੋਂ ਪਹਿਲਾਂ ਜਿਹੜਾ ਫੀਚਰ ਫਰਕ ਨਜ਼ਰ ਆਉਂਦਾ ਉਹ ਇਹਦੀ ਸਕਰੀਨ ਦਾ ਮੈਨੂੰ ਨਜ਼ਰ ਆਉਂਦਾ ਇੱਕ ਸਕਰੀਨ ਸਾਈਜ਼ ਬਹੁਤ ਵੱਡਾ ਹੋ ਗਿਆ ਉਹਦਾ ਸਕਰੀਨ ਛੋਟੀ ਹੁੰਦੀ ਸੀ ਬੈਟਰੀ ਲਾਈਫ ਵੱਧ ਗਈ ਪਹਿਲਾਂ ਬੈਟਰੀਆਂ ਬਹੁਤ ਛੋਟੀਆਂ ਹੁੰਦੀਆਂ ਸਨ ਬੈਟਰੀਆਂ ਵੱਡੀਆਂ ਹੋਣ ਲੱਗ ਗਈਆਂ ਲੋੜ ਵੀ ਹੈ ਨੈਟ ਚਲਦਾ ਫਾਈਵ ਜੀ ਤੱਕ ਅਸੀਂ ਪਹੁੰਚ ਗਏ ਕੈਮਰਾ ਦੇ ਉੱਤੇ ਬਹੁਤ ਫੋਕਸ ਨਜ਼ਰ ਆ ਰਿਹਾ ਕਿਉਂਕਿ ਨੋਰਮਲ ਕੈਮਰਾ ਹੁੰਦਾ ਸੀ ਮੋਬਾਇਲਾਂ 'ਚ ਫਿਰ ਦੋ ਕੈਮਰੇ ਤਿੰਨ ਕੈਮਰੇ ਕੁਯਾਡਕੋਰ ਹੁਣ ਚਾਰ ਚਾਰ ਕੈਮਰੇ ਵੀ ਹੁੰਦੇ ਨੇ ਏਆਈ ਬੇਸਡ ਹੋ ਗਏ ਨੇ ਕੈਮਰੇ ਅਠਤਾਲੀ ਮੈਗਾਪਿਕਸਲ ਹੁਣ ਮੈਂ ਜੇ ਆਪਣਾ ਮੋਬਾਇਲ ਅੱਜ ਦੇ ਲਈ ਗੱਲ ਕਰਾਂ ਅਠਤਾਲੀ ਮੈਗਾਪਿਕਸਲ ਦਾ ਕੈਮਰਾ ਇਕੱਲੀ ਇਕੱਲੀ ਡਿਟੇਲਿੰਗ ਫੋਟੋ ਦੀ ਹੁੰਦੀ ਹੈ ਵਿੱਚ ਕਲਿਕ ਵਧੀਆ ਲੱਗਦਾ ਮੈਕਰੋ ਲੈਂਸ ਆਉਣੇ ਸ਼ੁਰੂ ਹੋ ਗਏ ਨੇ ਇਹਨਾਂ ਦੇ ਵਿੱਚ ਬਹੁਤ ਕੋਲ ਦੀ ਕੋਈ ਫੋਟੋ ਖਿੱਚਣੀ ਹੈ ਤੁਸੀਂ ਕਿਸੇ ਚੀਜ਼ 'ਤੇ ਉਹ ਵੀ ਪੋਸੀਬਲ ਹੈ ਜਿਹੜੇ ਕਿ ਪੁਰਾਣੇ ਟਾਈਮ ਦੇ ਮੋਬਾਇਲ ਸਮਾਰਟ ਫੋਨਸ ਨਹੀਂ ਸੀ ਇੰਨਾ ਫੋਟੋ ਵਾਸਤੇ ਸੀ ਫਰੰਟ ਕੈਮਰਾ ਆਉਣਾ ਸ਼ੁਰੂ ਹੋਇਆ ਫਿਰ ਉਸਦੇ ਵਿੱਚ ਸੈਲਫੀਆਂ ਵਾਸਤੇ ਇਹਦੇ 'ਚ ਬਹੁਤ ਸਾਰੇ ਚੇਂਜਸ ਨੇ ਪ੍ਰੋਸੈਸਰ ਹੈ ਰੈ ਰੈਮ ਐਪਸ ਬਹੁਤ ਜ਼ਿਆਦਾ ਆ ਗਈਆਂ ਕਰਤੀ ਹਰ ਡੇਲੀ ਲਾਈਫ ਦੀਆਂ ਚੀਜ਼ਾਂ ਵਾਸਤੇ ਐਪ ਹੈ ਕੋਈ ਨਾ ਕੋਈ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਹੈ ਚਾਹੇ ਸ਼ੋਪਿੰਗ ਹੈ ਚਲੋ ਕਾਫੀ ਚੇਂਜਸ ਨੇ